ਫੋਟੋਗ੍ਰਾਫੀ ਸ਼ੁਰੂ ਕਰਨ ਲਈ ਮੈਨੂੰ ਕਿਸੇ ਖਾਸ ਚੀਜ਼ ਨੇ ਪ੍ਰੇਰਿਤ ਤਾਂ ਨਹੀਂ ਕੀਤਾ ਪਰ ਕਿਉਂਕਿ ਮੈਨੂੰ ਬਚਪਨ ਤੋਂ ਹੀ ਫੋਟੋਗ੍ਰਾਫੀ ਕਰਨੀ ਬਹੁਤ ਚੰਗੀ ਲੱਗਦੀ ਸੀ ਬੜਾ ਮੈਨੂੰ ਮਨ ਨੂੰ ਭਾਉਂਦੀ ਸੀ ਅਤੇ ਜਦੋਂ ਮੈਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸੇ ਪਹਾੜਾਂ 'ਤੇ ਘੁੰਮਣ ਫਿਰਨ ਲਈ ਜਾਂਦੇ ਹੁੰਦੇ ਸੀ ਤਾਂ ਮੈਨੂੰ ਉੱਥੇ ਜਾ ਕੇ ਕੁਦਰਤੀ ਜੋ ਫੋਟੋਆਂ ਹਨ ਉਹਨਾਂ ਦੀਆਂ ਤਸਵੀਰਾਂ ਕੁਦਰਤ ਦੀਆਂ ਤਸਵੀਰਾਂ ਲੈਣ ਦਾ ਬੜਾ ਸ਼ੌਕ ਹੁੰਦਾ ਸੀ ਇਸ ਕਰਕੇ ਮੈਨੂੰ ਇਹ ਹਮੇਸ਼ਾ ਹੀ ਫੋਟੋਗ੍ਰਾਫੀ ਕਰਨੀ ਵਧੀਆ ਲੱਗ ਅ ਲੱਗਦੀ ਸੀ ਅਤੇ ਹੁਣ ਵੀ ਲੱਗਦੀ ਹੈ ਅਤੇ ਮੈਂ ਕੋਈ ਖਾਸ ਟੀਚਾ ਨਹੀਂ ਹਾਸਲ ਕਰਨਾ ਚਾਹੁੰਦਾ ਇਹਦੇ ਵਿੱਚ ਬਸ ਮੈਨੂੰ ਐਦਾਂ ਹੁੰਦਾ ਆ ਬਈ ਮੈਂ ਇੱਕ ਕੁਦਰਤ ਦੀ ਜੋ ਕਿ ਜਿਵੇਂ ਕਿ ਕਈ ਵੇਲੇ ਵਰਖਾ ਪਈ ਹੁੰਦੀ ਆ ਮੀਂਹ ਪਿਆ ਹੁੰਦਾ ਹੈ ਮੌਸਮ ਬੜਾ ਸਾਫ ਹੁੰਦਾ ਹੈ ਪਹਾੜਾਂ ਦੀਆਂ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਹਨ ਕੁਦਰਤੀ ਫੋਟੋਆਂ ਲੈਣੀਆਂ ਦਾ ਮੈਨੂੰ ਬੜਾ ਸ਼ੌਕ ਹੁੰਦਾ ਹੈ